ਉਂਝ ਤਾਂ ਸਾਡੇ ਜ਼ਿਲ੍ਹੇ ਵਿੱਚ ਕਿਸੇ ਪ੍ਰਕਾਰ ਦੀਆਂ ਖੰਘ ਬਿਮਾ ਬ ਬੁਖਾਰ ਤੋਂ ਇਲਾਵਾ ਕੋਈ ਬਿਮਾਰੀਆਂ ਨਹੀਂ ਹਨ ਪਰ ਇੱਥੇ ਫੈਕਟਰੀਆਂ ਲੱਗਣ ਕਰਕੇ ਉਨ੍ਹਾਂ ਦੀ ਜਿਹੜੀ ਵੀ ਧੂੰਆਂ ਵਗੈਰਾ ਨੇ ਉਸ ਤੋਂ ਕਾਫੀ ਪ੍ਰਕਾਰ ਦੀਆਂ ਬਿਮਾਰੀਆਂ ਲੋਕਾਂ ਨੂੰ ਹੋਣ ਲੱਗ ਗਈਆਂ ਹਨ ਜਿਵੇਂ ਕਿ ਕੈਂਸਰ ਹੋ ਗਿਆ ਦਮੇ ਦੀ ਬਿਮਾਰੀ ਹੋ ਗਈ ਸਾਹ ਨਾ ਆਉਣ ਹਾਰਟ ਅਟੈਕ ਦੀਆਂ ਪ੍ਰੋਬਲਮਾਂ